ਸਤਿ ਸ਼੍ਰੀ ਅਕਾਲ ਸਰ ਪੰਜਾਬ ਟੈਕਸੀ ਸਟੈਂਡ ਤੋਂ ਸਰ ਮੈਨੂੰ ਚਾਰ ਅਤੇ ਛੇ ਸੀਟਾਂ ਵਾਲੀ ਟੈਕਸੀ ਬਾਰੇ ਦੱਸਿਓ ਕੱਲ੍ਹ ਚੰਡੀਗੜ ਜਾਣਾ ਅਸੀਂ ਕੀ ਰੇਟ ਲੱਗੇਗਾ ਚੰਡੀਗੜ ਜਾਣ ਲਈ ਕਿੰਨਾ ਸਮੇਂ ਲੱਗੇਗਾ ਪਹੁੰਚਣ ਦਾ ਸਮੇਂ ਕਿੰਨਾ ਲੱਗੇਗਾ ਚੰਡੀਗੜ ਪਾਸਪੋਰਟ ਦਫ਼ਤਰ ਵਿੱਚ ਪਰਿਵਾਰ ਨੂੰ ਲੈ ਕੇ ਜਾਣਾ ਹੈ ਫੋਟੋ ਹੋਣੀ ਹੈ ਮੌਸਮ ਖਰਾਬ ਹੈ ਕੱਲ੍ਹ ਨੂੰ ਮੋਰਚਾ ਵੀ ਲੱਗਿਆ ਹੋਇਆ ਹੈ ਟ੍ਰੈਫਿਕ ਜਾਮ ਮਿਲ ਸਕਦਾ ਹੈ ਸਾਨੂੰ ਟਾਈਮ ਸਿਰ ਠੀਕ ਠਾਕ ਪਹੁੰਚਾ ਦਿਉ ਧੰਨਵਾਦ